ਪਕਵਾਨ ਕਾਫੀ ਤਰ੍ਹਾਂ ਦੇ ਹੁੰਦੇ ਹਨ ਅਸੀਂ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਾਂ ਪਰ ਜਦ ਸਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੁੰਦਾ ਹੈ ਉਸ ਸਮੇਂ ਸਾਨੂੰ ਉਸਨੂੰ ਹਲਕਾ ਖਾਣਾ ਦੇਣਾ ਹੁੰਦਾ ਹੈ ਤਾਂ ਜੋ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਔਰ ਜਲਦੀ ਤੰਦਰੁਸਤ ਹੋ ਸਕੇ ਉਸ ਸਮੇਂ ਅਸੀਂ ਉਸ ਲਈ ਖਿਚੜੀ ਦਲੀਆ ਹਲਕਾ ਪਕਵਾਨ ਬਣਾਉਂਦੇ ਹਾਂ ਤਾਂ ਕਿ ਉਹ ਆਸਾਨੀ ਨਾਲ ਹਜਮ ਕਰਕੇ ਜਲਦੀ ਤੰਦਰੁਸਤ ਹੋ ਸਕੇ ਉਹਨੂੰ ਇਹ ਖਾਣਾ ਜਲਦੀ ਪੱਚ ਜਾਂਦਾ ਹੈ ਇਸ ਲਈ ਅਗਰ ਸਾਡੇ ਘਰ ਵਿੱਚ ਕੋਈ ਵੱਡਾ ਜਾਂ ਬੱਚਾ ਬਿਮਾਰ ਹੁੰਦਾ ਹੈ ਉਸ ਸਮੇਂ ਸਾਨੂੰ ਉਸਨੂੰ ਖਿਚੜੀ ਦਲੀਆ ਇਹੋ ਜਿਹਾ ਹਲਕਾ ਖਾਣਾ ਹੀ ਦੇਣਾ ਚਾਹੀਦਾ ਹੈ